ਇਸ ਖੇਤਰ ਵਿੱਚ ਵੇਖੇ ਜਾਣ ਵਾਲੇ ਪੰਛੀ ਜਿਵੇਂ ਕਿ ਤੋਤਾ ਕਬੂਤਰ ਕੋਇਲ ਉੱਲੂ ਇਸ ਤਰ੍ਹਾਂ ਦੇ ਬਹੁਤ ਹੋਰ ਵੀ ਸਾਰੇ ਪੰਛੀ ਹੁੰਦੇ ਹਨ ਜਿਨ੍ਹਾਂ ਵਿੱਚੋਂ ਕਿ ਮੈਨੂੰ ਤੋਤਾ ਅਤੇ ਕੋਇਲ ਸਭ ਤੋਂ ਹੀ ਵਧੀਆ ਲੱਗਦੇ ਹਨ ਤੋਤੇ ਨੂੰ ਤਾਂ ਮੈਂ ਆਪਣੇ ਘਰ ਵਿੱਚ ਹੀ ਰੱਖਿਆ ਹੋਇਆ ਹੈ ਪਿੰਜਰੇ ਵਿੱਚ ਉਸ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਉਸਦਾ ਨਾਮ ਮੈਂ ਮਿੱਠੂ ਰੱਖਿਆ ਹੋਇਆ ਹੈ ਉਸਨੂੰ ਮੈਂ ਰੋਜ਼ ਚੂਰੀ ਪਾਉਂਦੀ ਹਾਂ ਉਸ ਦੀ ਮੈਂ ਰੋਜ਼ ਸਾਫ਼ ਸਫ਼ਾਈ ਕਰਦੀ ਹਾਂ ਇਹ ਨਹੀਂ ਕਿ ਉਹ ਪਿੰਜਰੇ ਦੇ ਵਿੱਚ ਅਕਸਰ ਪਿਆ ਵਾ ਤਾਂ ਉਹ ਗੰਦਾ ਹੀ ਰਹੇ ਉਸਦੀ ਮੈਂ ਰੋਜ਼ ਸਾਫ਼ ਸਫ਼ਾਈ ਕਰਦੀ ਹਾਂ ਉਸਦੀ ਪਲੇਟ ਰੋਜ਼ ਸਾਫ਼ ਕਰਦੀ ਹਾਂ ਉਸ ਨੂੰ ਮੈਂ ਰੋਜ਼ ਨਵੀਂ ਚੂਰੀ ਦਿੰਦੀ ਹਾਂ ਖਾਣ ਨੂੰ ਉਹ ਮੇਰੇ ਨਾਲ ਕਈ ਵਾਰੀ ਗੱਲਾਂ ਵੀ ਕਰਦਾ ਹੈ ਉਸ ਨੂੰ ਮੈਂ ਬਹੁਤ ਸੋਹਣੇ ਅੱਖਰ ਸਿਖਾਉਂਦੀ ਹਾਂ ਉਹ ਮੇਰੇ ਬੱਚਿਆਂ ਨੂੰ ਵੀ ਬਹੁਤ ਪਸੰਦ ਹੈ ਅਸੀਂ ਉਸ ਨੂੰ ਵਾਹਿਗੁਰੂ ਸਤਿ ਸ਼੍ਰੀ ਅਕਾਲ ਇੱਦਾਂ ਦੇ ਲਫ਼ਜ਼ ਵੀ ਸਿਖਾਉਂਦੇ ਹਾਂ ਮੈਨੂੰ ਆਪਣੇ ਤੋਤੇ 'ਤੇ ਬਹੁਤ ਮਾਣ ਹੈ ਮੈਨੂੰ ਆਪਣਾ ਤੋਤਾ ਬਹੁਤ ਹੀ ਅੱਛਾ ਲੱਗਦਾ ਹੈ ਅਤੇ ਮੈਂਨੂੰ ਕੋਇਲ ਵੀ ਬਹੁਤ ਪਿਆਰੀ ਲੱਗਦੀ ਕੋਇਲ ਦੀ ਤਾਂ ਕੂਕ ਹੀ ਬਹੁਤ ਪਿਆਰੀ ਹੁੰਦੀ ਹੈ ਮੈਨੂੰ ਕੋਇਲ ਦਾ ਕੂਕਣਾ ਬੜਾ ਹੀ ਵਧੀਆ ਲੱਗਦਾ ਕੋਇਲ ਜਦੋਂ ਕੂਕਦੀ ਹੈ ਤਾਂ ਮੇਰੇ ਕੰਨਾਂ ਵਿੱਚ ਰਸ ਭਰ ਜਾਂਦਾ ਹੈ ਕੋਇਲ ਦਾ ਤਾਂ ਗਾਣਾ ਵੀ ਬਹੁਤ ਸੋਹਣਾ ਹੈ ਮੈਨੂੰ ਕੋਇਲ ਬਹੁਤ ਵਧੀਆ ਲੱਗਦੀ ਹੈ ਮੈਂ ਹਰ ਵਕਤ ਆਪਣੇ ਮਿੱਠੂ ਨਾਲ ਟਾਈਮ ਪਾਸ ਕਰਨਾ ਪਸੰਦ ਕਰਦੀ ਹਾਂ ਅਤੇ ਮੇਰੇ ਘਰ ਵਿੱਚ ਮੈਨੂੰ ਆਪਣੇ ਮਿੱਠੂ ਨਾਲ ਸਭ ਤੋਂ ਜ਼ਿਆਦਾ ਪ੍ਰੇਮ ਹੈ ਮੈਨੂੰ ਮਿੱਠੂ ਬਹੁਤ ਚੰਗਾ ਲੱਗਦਾ ਹੈ